ਹਾਂਜੀ ਪੰਜਾਬ ਦੇ ਪਿੰਡਾਂ ਵਿੱਚ ਅਕਸਰ ਹੀ ਮੱਛੀਆਂ ਫੜਨ ਅਤੇ ਮਨੋਰੰਜਨ ਦੇ ਉਦੇਸ਼ਾਂ ਦੇ ਲਈ ਹਮੇਸ਼ਾ ਹੀ ਕਮਿਊਨਿਟੀ ਤਲਾਬਾਂ ਝੀਲਾਂ ਅਤੇ ਹੋਰ ਵੀ ਜਲ ਸਰੋਤਾਂ ਦੀ ਵਰਤੋਂ ਕ ਵਰਤੋਂ ਬਾਰੇ ਵਿਵਾਦ ਹੁੰਦੇ ਰਹਿੰਦੇ ਹਨ ਕਿਉਂਕਿ ਕੁਝ ਲੋਕ ਕੁਝ ਲੋਕ ਇਹਨਾਂ ਜਲ ਸਰੋਤਾਂ ਦੀ ਵਰਤੋਂ ਮੱਛੀਆਂ ਫੜਨ ਦੇ ਲਈ ਕਰਦੇ ਹਨ ਅਤੇ ਕੁਝ ਲੋਕ ਚਾਹੁੰਦੇ ਹਨ ਕਿ ਇਹਨਾਂ ਜਲ ਸਰੋਤਾਂ ਦੇ ਜ਼ਰੀਏ ਸਿੰਚਾਈ ਕੀਤੀ ਜਾਵੇ ਅਤੇ ਇਹ ਇਹਨਾਂ ਹੀ ਮਸਲਿਆਂ ਨੂੰ ਲੈ ਕੇ ਹਮੇਸ਼ਾ ਹੀ ਪਿੰਡਾਂ ਵਿੱਚ ਝਗੜੇ ਹੁੰਦੇ ਰਹਿੰਦੇ ਹਨ ਪਿੱਛੇ ਜਿਹੇ ਇੱਕ ਘਟਨਾ ਹੈ ਮੇਰੇ ਪਿੰਡ ਵਿੱਚ ਜੋ ਕਿ ਵਾਪਰੀ ਸੀ ਉਸ ਵਿੱਚ ਕੁਝ ਲੋਕ ਅ ਮੱਛੀ ਫੜ ਕੇ ਇਹ 'ਚ ਹੀ ਮਤਲਬ ਤਲਾਬ ਦੇ ਵਿੱਚ ਮੱਛੀ ਫੜ ਕੇ ਮਨੋ ਮਨੋਰੰਜਨ ਕਰਵਾਉਣਾ ਚਾਹੁੰਦੇ ਸੀਗੇ ਅਤੇ ਪਰ ਬਾਕੀ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਸਨ ਅਤੇ ਉਹ ਇਹ ਚਾਹੁੰਦੇ ਸਨ ਕਿ ਇੱਥੇ ਸਿੰਚਾਈ ਦਾ ਕੰਮ ਕੀਤਾ ਜਾਵੇ ਮਤਲਬ ਉੱਥੋਂ ਦੇ ਪਾਣੀ ਤੋਂ ਸਿੰਚਾਈ ਕਰਵਾਈ ਜਾਵੇ ਅਤੇ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਫਿਰ ਪੰਚਾਇਤ ਬੁਲਾਈ ਗਈ ਅਤੇ ਪੰਚਾਇਤ ਦੇ ਵਿੱਚ ਇਸ ਮਸਲੇ ਦਾ ਹੱਲ ਕੱਢਿਆ ਗਿਆ ਫਿਰ ਪੰਚਾਇਤ ਦੇ ਮੇਨ ਮੈਂਬਰਾਂ ਦੇ ਨੇ ਇਹ ਕਿਹਾ ਕਿ ਇਸ ਝੀਲ ਜਾਂ ਇਸ ਤਲਾ ਤਲਾਬ ਜੋ ਵੀ ਆ ਉਸ ਨੂੰ ਦੋਨਾਂ ਕੰਮਾਂ ਦੇ ਲਈ ਵਰਤਿਆ ਜਾਵੇ ਉਸ ਨੂੰ ਸਿੰਚਾਈ ਲਈ ਵੀ ਵਰਤਿਆ ਜਾਵੇ ਅਤੇ ਉਸ ਨੂੰ ਮੱਛੀ ਫੜਨ ਦੇ ਉਦੇਸ਼ ਲਈ ਵੀ ਵਰਤੇ ਜਾਣ ਅਤੇ ਹਮੇਸ਼ਾ ਹੀ ਇੱਦਾਂ ਦੇ ਵਿਵਾਦ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਕੁਝ ਲੋਕ ਕਾਨੂੰਨੀ ਉਪਾਅ ਵੀ ਇਸ ਚੀਜ਼ ਨੂੰ ਲੈ ਕੇ ਕਰਦੇ ਹਨ ਅਤੇ ਮਤਲਬ ਉਹ ਕਾਨੂੰਨ ਕਾਨੂੰਨ ਦੇ ਰਸਤੇ ਵੀ ਅਪਣਾਉਂਦੇ ਹਨ ਧੰਨਵਾਦ